ਜੀ ਹਾਂ ਅਸੀਂ ਵਿਆਹ ਵਿੱਚ ਬਹੁਤ ਆਨੰਦ ਮਾਣਦੇ ਹਾਂ ਅਸੀਂ ਵਿਆਹ ਵਿੱਚ ਜਾਂਦੇ ਹਾਂ ਉੱਥੇ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਸਾਰਿਆਂ ਨਾਲ ਮਿਲ ਕੇ ਬਹਿੰਦੇ ਹਾਂ ਗੱਲਾਂ ਬਾਤਾਂ ਮਾਰਦੇ ਹਾਂ ਖੂਬ ਆਨੰਦ ਮਾਣਦੇ ਹਾਂ ਖਾਣਾ ਖਾਂਦੇ ਹਾਂ ਇੱਧਰ ਉੱਧਰ ਘੁੰਮ ਕੇ ਵੇਖਦੇ ਹਾਂ ਜੋੜੀ ਨੂੰ ਵੇਖਦੇ ਹਾਂ ਬਹੁਤ ਸੋਹਣੀ ਜੋੜੀ ਸਜੀ ਹੁੰਦੀ ਹੈ ਸਾਰਿਆਂ ਨਾਲ ਰਲ ਮਿਲ ਕੇ ਜੋੜੀ ਨਾਲ ਫਿਰ ਰਲ ਕੇ ਅਸੀਂ ਭੰਗੜਾ ਵੀ ਪਾਉਂਦੇ ਉਹਨਾਂ ਨੂੰ ਨਚਾਉਂਦੇ ਵੀ ਹਾਂ ਬੜਾ ਹੀ ਆਨੰਦ ਆਉਂਦਾ ਹੈ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਅਸੀਂ ਉੱਥੇ ਜਾਂਦੇ ਹਾਂ ਉੱਥੇ ਲੋਕ ਗੀਤ ਲੋਕ ਨਾਚ ਵੇਖਦੇ ਵੀ ਹਾਂ ਕਰਦੇ ਵੀ ਹਾਂ ਜਿੱਦਾਂ ਗੀਤਕਾਰਾਂ ਦੇ ਗਾਣੇ ਹੁੰਦੇ ਆ ਪੰਜਾਬੀ ਗਾਣੇ ਲੋਕ ਗਾਣੇ ਉਹਨਾਂ 'ਤੇ ਡਾਂਸ ਵੀ ਕੀਤਾ ਜਾਂਦਾ ਨੱਚੇ ਟੱਪਿਆ ਜਾਂਦਾ ਲੋਕ ਗੀਤ ਕਈ ਗਾਏ ਜਾਂਦੇ ਨੇ ਡਾਂਸ ਉੱਥੇ ਆਣ ਕੇ ਕਰਦੇ ਨੇ ਅਤੇ ਅਸੀਂ ਵੀ ਖੂਬ ਆਨੰਦ ਮਾਣਦੇ ਉਹਨਾਂ ਦਾ ਉਹਦੇ ਭੰਗੜਾ ਪਾਉਂਦੇ ਸੱਭਿਆਚਾਰ ਨੱਚਦੇ ਟੱਪਦੇ ਹਾਂ ਖੂਬ ਖਾਂਦੇ ਪੀਂਦੇ ਹਾਂ ਅਤੇ ਆਨੰਦ ਮਾਣਦੇ ਹਾਂ ਅਤੇ ਸਾਰੇ ਰਿਸ਼ਤੇਦਾਰਾਂ ਭੈਣ ਭਰਾ ਨਾਲ ਗੱਪਾਂ ਸ਼ੱਪਾਂ ਮਾਰਦੇ ਹਾਂ ਅਤੇ ਆਪਣਾ ਵਧੀਆ ਟਾਈਮ ਸਪੈਂਡ ਕਰਦੇ ਹਾਂ ਆਨੰਦ ਮਾਣਦੇ ਹਾਂ ਖੂਬ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਨਾਲ ਬੜਾ ਸੋਹਣਾ ਆਨੰਦ ਆਉਂਦਾ ਵਿਆਹ ਵੇਖਣ ਦਾ ਅਤੇ ਉੱਥੇ ਵਿਆਹ ਵਿੱਚ ਲੱਗੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਗਾਣਿਆ 'ਤੇ ਨੱਚਣ ਟੱਪਣ ਦਾ ਵੀ